ਮੈਂ ਸ਼ੀਤਲ ਕੁਮਾਰੀ ਮਿਰਜ਼ਾਪੁਰ ਪਿੰਡ ਪਠਾਨਕੋਟ ਜ਼ਿਲ੍ਹੇ ਵਾਸੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਸਮੇਂ ਵਿੱਚ ਜੇਕਰ ਅਸੀਂ ਗੱਲ ਪੀੜ੍ਹੀ ਨੂੰ ਇਤਿਹਾਸ ਦੀਆਂ ਗੱਲਾਂ ਬਾਰੇ ਜਾਣੂ ਕਰਵਾਈਏ ਤਾਂ ਇਹ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਇਤਿਹਾਸ ਵਿੱਚ ਕੁਝ ਵਾਪਰਿਆ ਅਤੇ ਇਸ ਤਰ੍ਹਾਂ ਉਹ ਇਸ ਸਮੇਂ ਮੁਤਾਬਕ ਅੱਜ ਦੇ ਦੌਰ ਨੂੰ ਯਾਦ ਰੱਖਣਗੇ ਮੈਂ ਇਹ ਗੱਲ ਕਹਿ ਰਹੀ ਹਾਂ ਕਿ ਜੇਕਰ ਇਤਿਹਾਸ ਵਿੱਚ ਇਹ ਸਮਾਂ ਬੱਚਿਆਂ ਨੂੰ ਸਿਖਾਇਆ ਜਾਵੇ ਤਾਂ ਉਹ ਆਉਣ ਵਾਲੇ ਸਮੇਂ ਦੀਆਂ ਜਾਂ ਪੁਰਾਣੇ ਸਮੇਂ ਦੀਆਂ ਇਤਿਹਾਸ ਦੀਆਂ ਗੱਲਾਂ ਨੂੰ ਯਾਦ ਰੱਖਣਗੇ ਜਿਸ ਤਰ੍ਹਾਂ ਛੋਟੇ ਹੁੰਦੇ ਛੋਟੇ ਛੋਟੇ ਬੱਚੇ ਬੱਚਿਆਂ ਨੂੰ ਬਾਬਾ ਦਾਦੀ ਛੋਟੀ ਛੋਟੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਸੁਣਾਉਂਦੇ ਨੇ ਇੱਕ ਰਾਜਾ ਸੀ ਇੱਕ ਰਾਣੀ ਸੀ ਜਾਂ ਇੱਕ ਰਾਜਾ ਸੀ ਉਹ ਬੜਾ ਦਲੇਰ ਸੀ ਉਸਨੇ ਆਪਣੇ ਰਾਜ ਭਾਗ ਨੂੰ ਬਚਾਉਣ ਲਈ ਬੜੀ ਲੰਘਣਾ ਲੰਘੀ ਅਤੇ ਬੜੀ ਮਿਹਨਤ ਕੀਤੀ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਾਣੀਆਂ ਕਿ ਉਹ ਦਿਆਲੂ ਭਰਪੂਰ ਰਾਜੇ ਸਨ ਜਾਂ ਪਰ ਜਾਂ ਉਹ ਇੱਕ ਪਾਰਸ ਦਾ ਕੰਮ ਕਰਦੇ ਸਨ ਜਾਂ ਅਸੀਂ ਹੋਰ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਜਿਹੜੀਆਂ ਕਿ ਬੱਚਿਆਂ ਨੂੰ ਸੁਣਾਉਂਦੇ ਹਾਂ ਅਤੇ ਬੱਚੇ ਹਮੇਸ਼ਾ ਹੀ ਯਾਦ ਰੱਖਦੇ ਹਨ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਜੇਕਰ ਆਉਣ ਵਾਲੀ ਪੀੜ੍ਹੀ ਨੂੰ ਇਹ ਕਹਾਣੀਆਂ ਬਾਰੇ ਜਾਣੂ ਨਹੀਂ ਕਰਵਾਇਆ ਤਾਂ ਉਹਨਾਂ ਨੂੰ ਇਹ ਕਹਾਣੀਆਂ ਦਾ ਕਿਸਮੇ ਪਤਾ ਲੱਗੇਗਾ ਜਿਸ ਕਰਕੇ ਅਜਿਹਾ ਸਕਦਾ ਹੈ ਕਿ ਸਾਡੀ ਆਉਣ ਵਾਲੀ ਜਨੈਨੇਸ਼ਨ ਲਈ ਉਹਨਾਂ ਨੂੰ ਇਤਿਹਾਸ ਪੜ੍ਹਾਉਣਾ ਜ਼ਰੂਰੀ ਹੈ ਕਿ ਤੁਸੀਂ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਕਹਾਣੀਆਂ ਸੁਣਾਉਣਗੇ ਤਾਂ ਉਹ ਸਦਾ ਹੀ ਇਹ ਗੱਲ ਯਾਦ ਰੱਖਣ ਦੇ ਸਮੇਂ ਨਾਲ ਨਾਲ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਉਹ ਰਾਜੇ ਮਹਾਰਾਜੇ ਰਾਜ ਕਰਕੇ ਇਸ ਸਮਾਜ ਤੋਂ ਚਲੇ ਗਏ ਜਿਸ ਤਰ੍ਹਾਂ ਅੱਜ ਲੋਕਤੰਤਰ ਦਾ ਦੇਸ਼ ਹੈ ਭਾਰਤ ਵਿੱਚ ਲੋਕਤੰਤਰ ਪ੍ਰਣਾਲੀ ਦੀ ਵਿਸ਼ੇਸਤਾ ਦੇ ਸਦਕਾ ਅਸੀਂ ਅੱਜ ਇਹ ਮਿਹਨਤ ਦੇ ਨਾਲ ਜਾਂ ਇਕਜੁਟਤਾ ਦੇ ਨਾਲ ਇੱਕ ਰਾਜੇ ਨੂੰ ਰਾਜਾ ਬਣ ਬਣਾ ਦਿੰਦੇ ਹਾਂ ਇਸੇ ਤਰ੍ਹਾਂ ਸਾਨੂੰ ਬੱਚਿਆਂ ਨੂੰ ਇਹ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ ਧੰਨਵਾਦ ਜੀ